ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਹੈ ਬਾਈ ਠੀਕ ਆ ਬਾਈ ਹਾਂਜੀ ਹਾਂਜੀ ਹਾਂਜੀ ਹਾਂਜੀ ਬਾਈ ਮੈਂ ਇਹਦਾ ਟੂਰਿਸਟ ਗਾਈਡ ਦਾ ਹੀ ਕੰਮ ਕਰਦਾ ਅਤੇ ਆਪਣੇ ਇੱਧਰ ਮਸ਼ਹੂਰ ਪਾਰਕ ਹੈਗਾ ਵੀਰੇ ਬ ਬਾਰਾਦਰੀ ਗਾਰਡਨ ਇਹਦਾ ਵੀਰੇ ਬਾਰਾਦਰੀ ਨਾਮ ਤਾਂ ਪਿਆ ਇਹਦੇ ਬਾਰ੍ਹਾਂ ਗੇਟ ਨੇ ਠੀਕ ਆ ਬਾਈ ਇਹ 'ਚ ਸਾਰੇ ਤਰ੍ਹਾਂ ਦੀਆਂ ਸੁਵਿਧਾ ਉਪਲਬਧ ਉਪਲਬਧ ਨੇ ਬਈ ਕੋਈ ਵੀ ਤਰ੍ਹਾਂ ਦੀ ਝੂਲੇ ਹੈਗੇ ਨੇ ਜਵਾਕਾਂ ਵਾਸਤੇ ਸੌ ਸੌ ਸਾਲ ਪੁਰਾਣੇ ਪੇੜ ਹੈਗੇ ਨੇ ਸਾਰਾ ਕੁਛ ਆ ਬਾਈ ਇਹ ਤੋਂ ਬਾਅਦ ਹੈਗਾ ਬਈ ਆਪਣੇ ਰੋਜ਼ ਗਾਰਡਨ ਵੀ ਆ ਉਹ ਬੱਸ ਸਟੈਂਡ ਕੋਲ ਉਹ ਵੀ ਇਹ ਬਈ ਆਪਣੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਕੋਲ ਆ ਬੱਸ ਸਟੈਂਡ ਦੇ ਨਾਲ ਹੀ ਅਤੇ ਇੱਥੇ ਬਈ ਅਲੱਗ ਅਲੱਗ ਤਰ੍ਹਾਂ ਦੇ ਜਿਵੇਂ ਫੁੱਲ ਵੀ ਬਹੁਤ ਹੀ ਜ਼ਿਆਦਾ ਸੋਹਣਾ ਪਾਰਕ ਆ ਅਤੇ ਇਸ ਤੋਂ ਇਲਾਵਾ ਬਈ ਹੋਰ ਵੀ ਪਾਰਕ ਹੈਗੇ ਨੇ ਜਿਵੇਂ ਆਪਣੇ ਥਾਪਰ ਯੂਨੀਵਰਸਿਟੀ 'ਚ ਵੀ ਪਾਰਕ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਇਹ ਬਾਈ ਇੱਧਰ ਆਪਣਾ ਨਾਭਾ ਰੋਡ 'ਤੇ ਆ ਗਈ ਹਾਂਜੀ ਹਾਂਜੀ ਬਈ ਇਹ ਵੀ ਬਾਈ ਟੂਰਿਸਟ ਪਲੇਸ ਹੈਗੀ ਆ ਇੱਥੇ ਵੀ ਲੋਕ ਘੁੰਮਣ ਆਉਂਦੇ ਨੇ ਇਸ ਤੋਂ ਇਲਾਵਾ ਆਪਣੇ ਪੰਜਾਬੀ ਯੂਨੀਵਰਸਿਟੀ ਵੀ ਹੈਗੀ ਆ ਉਥੇ ਵੀ ਪਾਰਕ ਬਹੁਤ ਸੋਹਣੀ ਆ ਕਿਉਂਕਿ ਉੱਥੇ ਬਹੁਤ ਅੱਡ ਅੱਡ ਜਿਵੇਂ ਵਧੀਆ ਉਹ ਨੇ ਵਿਊ ਵੀ ਬਹੁਤ ਸੋਹਣਾ ਬਾਈ ਹਾਂ ਹਾਂ ਬਾਈ ਹੋਰ ਕੋਈ ਵੀ ਜਾਣਕਾਰੀ ਜਾਣਾ ਚਾਹੁੰਦੇ ਹਾਂਜੀ ਵੀਰੇ ਹਾਂ ਹਾਂ ਬਾਈ ਨਹੀਂ ਗਾਰਡਨ ਬਾਈ ਬਹੁਤ ਵਧੀਆ ਨੇ ਇੱਕ ਤੋਂ ਇੱਕ ਗਾਰਡਨ ਨੇ ਉਰੇ ਜਿੱਥੇ ਜਾਣਾ ਚਾਹੁੰਦੇ ਹੋ ਤੁਸੀਂ ਮੈਨੂੰ ਉਹ ਕਰਿਓ ਦੱਸਿਓ ਹਾਂ ਹਾਂ

ਉਹ ਤਾਂ ਫਿਰ ਵੀਰੇ ਤੁਹਾਨੂੰ ਸਾਰਿਆਂ ਨਾਲੋਂ ਵਧੀਆ ਛੋਟੀ ਬਾਰਾਦਰੀ ਸੂਟ ਬੈਠੇਗਾ ਕਿਉਂਕਿ ਉਹ ਪ ਪਾਰਕ ਬਹੁਤ ਹਾਂ ਵੀਰੇ ਕਿਉਂਕਿ ਹਾਂਜੀ ਹਾਂਜੀ ਕਿਉਂਕਿ ਉੱਥੇ ਨਾ ਐਕਸਰਸਾਈਜ਼ ਕਰਨ ਲਈ ਸਮਾਨ ਬਹੁਤ ਆ ਜ ਜਿੰਮ ਦਾ ਸਮਾਨ ਅਤੇ ਹਾਂ ਹਾਂ ਹਾਂ ਹਾਂ ਉੱਥੇ ਸਾਰਾ ਕੁਛ ਅਵੇਲੇਬਲ ਆ ਤਾਂ ਕਰਕੇ ਤੁਸੀਂ ਵੀ ਕੋਈ ਵੀ ਐਕਸਰਸਾਈਜ਼ ਕਰ ਸਕਦੇ ਹੋ ਹਾਂਜੀ ਹਾਂਜੀ ਓਕੇ ਓ ਓਕੇ ਬਾਈ ਓਕੇ ਓਕੇ ਜੀ ਓਕੇ